ਸਾਹਿਤ ਕਵਿਤਾ ਅਤੇ ਕਲਾਤਮਿਕ ਪ੍ਰਗਟਾਵੇ ਦੇ ਹੋਰ ਰੂਪਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਬੋਲ ਕੇ ਲਿੱਖ ਕੇ ਗਾ ਕੇ ਕੀਤੀ ਜਾਂਦੀ ਹੈ